ਭਾਰਤ ਵਿੱਚ ਕਈ ਸਾਰੇ ਧਾਰਮਿਕ ਸਥਾਨ ਹਨ ਜਿਵੇਂ ਦਰਬਾਰ ਸਾਹਿਬ ਅਨੰਦਪੁਰ ਸਾਹਿਬ ਫਤਿਹਗੜ੍ਹ ਸਾਹਿਬ ਰੋਪੜ ਸਾਹਿਬ ਜਿਵੇਂ ਕਿ ਵੱਖਰੇ ਵੱਖਰੇ ਧਾਰਮਿਕ ਸਥਾਨਾਂ 'ਤੇ ਵੱਖਰਾ ਵੱਖਰਾ ਹੀ ਪ੍ਰੋਗਰਾਮ ਕੀਤਾ ਜਾਂਦਾ ਹੈ ਉਹਨਾਂ ਵਿੱਚੋਂ ਅੱਜ ਮੈਂ ਇੱਕ ਦੀ ਗੱਲ ਕਰਨ ਜਾ ਰਿਹਾ ਹਾਂ ਦਰਬਾਰ ਸਾਹਿਬ ਦੀ ਇੱਥੇ ਵਿਸਾਖੀ ਦਾ ਮੇਲਾ ਬੜੇ ਧੂਮਧਾਮ ਨਾਲ ਮਨਾਇਆ ਜਾਂਦਾ ਹੈ ਇੱਥੇ ਲੋਕ ਬੜੇ ਦੂ ਇੱਥੇ ਸ਼ਰਧਾਲੂ ਬੜੇ ਦੂਰੋਂ ਦੂਰੋਂ ਤਰ੍ਹਾਂ ਆਉਂਦੇ ਹਨ ਜਿਵੇਂ ਕਿ ਕੋਈ ਹਿਮਾਚਲ ਤੋਂ ਆ ਰਿਹਾ ਕੋਈ ਪਠਾਨਕੋਟ ਤੋਂ ਆ ਰਿਹਾ ਕੋਈ ਕਰਨਾਟਕਾ ਤੋਂ ਆ ਰਿਹਾ ਕੋਈ ਕਿੱਧਰੋਂ ਕੋਈ ਕਿੱਧਰੋਂ ਇੱਥੇ ਲੋਕ ਦੂਰੋਂ ਦੂਰੋਂ ਆਉਂਦੇ ਹਨ ਅਤੇ ਆਪਣੀ ਹਾਜ਼ਰੀ ਭਰਦੇ ਹਨ ਇੱਥੇ ਲੋਕ ਬੜੇ ਧਾਮ ਧੂਮਧਾਮ ਨਾਲ ਜਸ਼ਨ ਮਨਾਉਂਦੇ ਹਨ ਨਾਲੇ ਗੁਰੂ ਜੀ ਦੇ ਦਰਸ਼ਨ ਕਰਦੇ ਹਨ ਗੁਰੂ ਜੀ ਦੇ ਦਰਸ਼ਨ ਕਰਨ ਲੋਕ ਲਾਈਨ 'ਚ ਲੱਗਦੇ ਹਨ ਨਾਲੇ ਸੱਚੇ ਸੁੱਚੇ ਮਨ ਜੋ ਸ਼ਰਧਾ ਨਾਲ ਆਉਂਦਾ ਹੈ ਉਹ ਆਪਣੀ ਆਸ਼ਾ ਮੁਰਾਦਾਂ ਦੇ ਨਾਲ ਹੀ ਪੂਰੀਆਂ ਨੂੰ ਲੈ ਕੇ ਜਾਂਦਾ ਹੈ ਇੱਥੇ ਲੰਗਰ ਹਾਲ ਵੀ ਬਹੁਤ ਤਕੜਾ ਬਣਿਆ ਹੋਇਆ ਹੈ ਜਿੱਥੇ ਸੁੱਖ ਸ਼ਰਧਾਲੂ ਦੂਰੋਂ ਦੂਰੋਂ ਆ ਕੇ ਲੰਗਰ ਲੰਗਰ ਛਕਦੇ ਹਨ ਇੱਥੇ ਸੇਵਾ ਵੀ ਸੇਵਾ ਕਰਨ ਵਾਲੇ ਕਰਮਚਾਰੀ ਬ ਕਰਮਚਾਰੀ ਬੜੇ ਵਧੀਆ ਹਨ ਸਾਰਾ ਸਪ ਸਟਾਫ ਦਰਬਾਰ ਸਾਹਿਬ ਦਾ ਬਹੁਤ ਹੀ ਕੋਆਪਰੇਟਿਵ ਹੈ ਇੱਥੇ ਜੇ ਕੋਈ ਵੀ ਆਈ ਪੀ ਵੀ ਆਉਂਦਾ ਉਹਨੂੰ ਸਪੈਸ਼ਲ ਟ੍ਰੀਟਮੈਂਟ ਦਿੱਤਾ ਜਾਂਦਾ ਹੈ ਇੱਥੇ ਹਰ ਇੱਕ ਤਰ੍ਹਾਂ ਦੇ ਹਰ ਇੱਕ ਤਰ੍ਹਾਂ ਦਾ ਤਿਉਹਾਰ ਬੜੇ ਧੂਮਧਾਮ ਦਾ ਮਨਾਇਆ ਜਾਂਦਾ ਹੈ ਦਰਬਾਰ ਸਾਹਿਬ ਲੰਗਰ ਚੌਵੀ ਘੰਟੇ ਅਟੁੱਟ ਚੱਲਦਾ ਹੈ ਜੀ ਜੇਕਰ ਕਿਸੇ ਦਿਨ ਵਿਸਾਖੀ ਦਾ ਮੇਲਾ ਹੁੰਦਾ ਹੈ ਉਸ ਦਿਨ ਤਾਂ ਚੌਵੀ ਘੰਟੇ ਤੋਂ ਵੀ ਵੱਧ ਚੌਵੀ ਘੰਟੇ ਤੋਂ ਰੌਣਕਾਂ ਹੀ ਰੌਣਕਾਂ ਲੱਗੀਆਂ ਰਹਿੰਦੀਆਂ ਲਾਈਵ ਪ੍ਰਸਾਰਣ ਚੱਲਦਾ ਹੈ ਲੋਕ ਬੜੀ ਦੂਰੋਂ ਦੂਰੋਂ ਆ ਕੇ ਮੱਥਾ ਟੇਕਦੇ ਨੇ ਨਤਮਸਤਕ ਹੁੰਦੇ ਨੇ ਇਸ਼ਨਾਨ ਕਰਦੇ ਹਨ ਨਾਲੇ ਹੋਰ ਵੀ ਕਈ ਸਾਰੀਆਂ ਇਨ ਹ ਕਈ ਹੋਰ ਸਾਰੀਆਂ ਧਾਰਮਿਕ ਸਥਾਨਾਂ ਹਨ ਤਾਂ ਸੋ ਇਨ੍ਹਾਂ ਵਿੱਚੋਂ ਸਭ ਨਾਲੋਂ ਵਧੀਆ ਤਾਂ ਦਰਬਾਰ ਸਾਹਿਬ ਹੈ ਜਿੱਥੇ ਲੋਕ ਬੜੀ ਦੂਰੋਂ ਦੂਰੋਂ ਆਉਂਦੇ ਹਨ